ਅੱਜ ਤੱਕ ਸਭ ਤੋਂ ਸੁੰਦਰ ਅਤੇ ਵਿਲੱਖਣ ਜਿਹੜੀ ਮੈਂ ਚੜ੍ਹਾਈ ਚੜ੍ਹੀ ਹੈ ਉਹ ਹੈਗੀ ਹੈ ਨੈਣਾਂ ਦੇਵੀ ਦੀ ਅਤੇ ਨੈਣਾਂ ਦੇਵੀ ਦੇ ਪਹਾੜ 'ਤੇ ਜਦ ਅਸੀਂ ਚੜ੍ਹੇ ਹਾਂ ਅਤੇ ਪੌੜੀਆਂ ਰਾਹੀ ਚੜ੍ਹੇ ਹਾਂ ਅਤੇ ਉੱਥੇ ਜਿਵੇਂ ਜਿਵੇਂ ਅਸੀਂ ਪੌੜੀਆਂ ਚੜ੍ਹਦੇ ਗਏ ਉਵੇਂ ਉਵੇਂ ਸਾਨੂੰ ਵਧੀਆ ਵਧੀਆ ਦ੍ਰਿਸ਼ ਵਧੀਆ ਵਧੀਆ ਨਜ਼ਾਰੇ ਹੈ ਨਾ ਦੇਖਣ ਨੂੰ ਮਿਲੇ ਅਤੇ ਇੱਕ ਟਾਇਮ ਤਾਂ ਇੱਕ ਸਮਾਂ ਤਾਂ ਇਹੋ ਜਿਹਾ ਆਇਆ ਕਿ ਜਿਹਦੇ ਵਿੱਚ ਅਸੀਂ ਬੱਦਲਾਂ ਤੋਂ ਵੀ ਉੱਪਰ ਚੜ੍ਹ ਗਏ ਸਾਂ ਅਤੇ ਥੱਲੇ ਕੁਛ ਵੀ ਨਹੀਂ ਦਿਖਦਾ ਸੀ ਧਰਤੀ ਵੀ ਨਹੀਂ ਦਿਖਦੀ ਸੀ ਅਤੇ ਉਹ ਨਜ਼ਾਰਾ ਹੀ ਵੱਖ ਸੀਗਾ ਅਤੇ ਉੱਥੇ ਸਾਨੂੰ ਦੇਖਣ ਨੂੰ ਹੈ ਨਾ ਇੱਕੋ ਜਾਨਵਰ ਮਿਲਿਆ ਬਾਂਦਰ ਕਿਉਂਕਿ ਉਹ ਵੀ ਚੜ੍ਹਾਈ ਬਹੁਤ ਚੜ੍ਹਦੇ ਹੈ ਨਾ ਅਤੇ ਉਨ੍ਹਾਂ ਨੂੰ ਦੇਖ ਕੇ ਵੀ ਸਾਨੂੰ ਬੜਾ ਅਚੰਭਾ ਹੋਇਆ ਕਿ ਵੀ ਇਹ ਜਾਨਵਰ ਵੀ ਇੰਨੀ ਇੰਨੀ ਉੱਚੀ ਉੱਚੀ ਪਹਾੜੀਆਂ 'ਤੇ ਰਹਿੰਦੇ ਹਨ ਅਤੇ ਆਹੀ ਦ੍ਰਿਸ਼ ਦੇਖ ਕੇ ਮੇਰਾ ਮਨ ਤ੍ਰਿਪਤ ਹੋ ਗਿਆ